ਮੇਰੇ ਕੋਲ ਲਗਭਗ ਦਸ ਤਰ੍ਹਾਂ ਦੀ ਮਤਲਬ ਮੋਟਰਸਾਈਕਲ ਮੇਰੇ ਕੋਲ ਹੈਗੇ ਨੇ ਜਿਸ 'ਚ ਆਪਾਂ ਸਟਾਰਟਿੰਗ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬੀ ਦੀ ਜਿਹੜੀ ਮੇਨ ਪਸੰਦ ਹੁੰਦੀ ਉਹ ਬੁਲਟ ਹੈਗਾ ਹੈ ਫਿਰ ਮੇਰੇ ਕੋਲ ਕ ਇੱਕ ਘਰ ਪੈਸ਼ਨ ਖੜ੍ਹਾ ਇੱਕ ਸਪਲੈਂਡਰ ਖੜ੍ਹਾ ਅਤੇ ਉਸ ਤੋਂ ਬਾਅਦ ਮੇਰੇ ਕੋਲ ਇੱਕ ਕੇ ਟੈਂਨ ਇੱਕ ਹੰਕ ਅਤੇ ਇੱਕ ਮੇਰੇ ਕੋਲ ਖੜ੍ਹਾ ਹੈ ਉਹਦਾ ਆ ਹਾਰਲੇ ਕੰਪਨੀ ਦਾ ਹੁੰਦਾ ਹੈ ਜਿਹੜਾ ਸਟਾਰਟ ਮਾਡਲ ਹੁੰਦਾ ਫਸਟ ਮਾਡਲ ਉਹ ਖੜ੍ਹਾ ਅਤੇ ਜਿਹੜੀ ਮੇਰੀ ਸਭ ਤੋਂ ਇਹਦੇ ਮਨਪਸੰਦ ਬਾਈਕ ਹੈਗੀ ਉਹ ਹੈਗੀ ਹੈ ਬੁਲਟ ਕਿਉਂਕਿ ਬੁਲਟ ਇੱਕ ਤੁਹਾਨੂੰ ਪਤਾ ਇੱਕ ਜਾਨਦਾਰ ਅਤੇ ਸ਼ਾਨਦਾਰ ਸਵਾਰੀ ਮੰ ਮੰਨੀ ਜਾਂਦੀ ਹੈ ਅਤੇ ਬੁਲਟ ਨਾਲ ਇੱਕ ਚਲਾਉਣ ਦਾ ਆਪਣਾ ਇੱਕ ਵੱਖਰਾ ਮਜਾ ਆਉਂਦਾ ਹੈ ਅਤੇ ਬਾਈਕ ਯਾਤਰਾਵਾਂ ਵਾਸਤੇ ਅਗਰ ਤੁਸੀਂ ਸੋਚੋ ਤਾਂ ਬੁਲਟ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਕਿਉਂਕਿ ਇੱਕ ਤਾਂ ਉਹਦੀ ਪਿਕਅਪ ਬਹੁਤ ਹੁੰਦੀ ਹੈ ਅਤੇ ਇੱਕ ਉਹ ਪਹਾੜੀ ਯਾਤਰਾ ਵਿੱਚ ਇਹ ਆਪਾਂ ਜੋ ਯਾਤਰਾ ਕਰਨ ਜਾਂਦੇ ਹਾਂ ਹਿਮਾਚਲ ਘੁੰਮਣ ਜਾਂਦੇ ਹਾਂ ਅਤੇ ਜਾਂ ਆਪਾਂ ਉੱਚੀਆਂ ਜਗ੍ਹਾਵਾਂ 'ਤੇ ਜਾਂਦੇ ਹਾਂ ਜਿੱਦਾਂ ਜਦੋਂ ਧਰਮਸ਼ਾਲਾ ਹੋ ਗਿਆ ਜਾਂ ਮਕਲੋੜਗੰਜ ਹੋ ਗਿਆ ਜਾਂ ਸ਼ਿਮਲਾ ਮਨਾਲੀ ਜਾਂ ਉਸ ਤੋਂ ਉੱਪਰ ਰੋਹਤਾਂਗ ਵਗੈਰਾ ਹੈਗੇ ਆ ਅਤੇ ਉੱਥੇ ਮੇਨ ਬੁੱਲਟ ਹੀ ਕਾਮਯਾਬ ਹੈ ਕਿਉਂਕਿ ਉੱਥੇ ਇੱਕ ਤਾਂ ਇੰਜਨ ਕਾਫੀ ਸੀ ਸੀ ਦਾ ਹੁੰਦਾ ਹੈ ਅਤੇ ਦੂਜੀ ਗੱਲ ਕਿ ਉਹਦੀ ਪਿਕਅਪ ਬਹੁਤ ਹੁੰਦੀ ਹੈ ਅਤੇ ਉਹ ਬਾਈਕ ਇੰਨਾ ਜਿਹੜੀ ਸ ਖ਼ਰਾਬ ਸੜਕਾਂ 'ਤੇ ਵੀ ਆਰਾਮ ਨਾਲ ਚੱਲ ਲੈਂਦਾ ਜਿਹਦੇ ਨਾਲ ਕੋਈ ਵੀ ਅ ਚਲਾਉਣ ਵਾਲੇ ਬੰਦੇ ਨੂੰ ਸੱਟ ਫੇਟ ਨਹੀਂ ਲੱਗਦੀ ਅਤੇ ਮੇਰੇ ਹਿਸਾਬ ਨਾਲ ਵੀ ਬੁਲਟ ਦੇ ਉੱਪਰ ਕੋਈ ਬਾਈਕ ਨਹੀਂ ਹੈਗੀ ਅਤੇ ਅਗਰ ਮੈਂ ਸੋਚਾਂ ਵੀ ਮੇਰੀ ਡਰੀਮ ਬਾਈਕ ਮੇਰੀ ਡਰੀਮ ਬਾਈਕ ਹੈਗੀ ਹਾਰਲੇ ਦਾ ਟੋਪ ਮਾਡਲ ਜਿਹੜਾ ਹੁੰਦਾ ਹੈ ਉਹਦੇ 'ਚ ਲਿਮਿਟਡ ਐਡੀਸ਼ਨ ਆਉਂਦਾ ਹੈ ਅਤੇ ਜਿਹਦੀ ਇਸ ਟਾਈਮ ਕੀਮਤ ਹੈਗੀ ਕੋਈ ਸਵਾ ਕਰੋੜ ਦੇ ਲਾਗੇ ਤਾਗੇ ਅਤੇ ਉਹ ਮੇਰੀ ਡਰੀਮ ਬਾਈਕ ਹੈ ਅਤੇ ਮੈਂ ਉਹ ਇਨ ਫਿਊਚਰ ਅਗਰ ਮੈਨੂੰ ਮੌਕਾ ਮਿਲਦਾ ਤਾਂ ਮੈਂ ਉਹ ਖਰੀਦਣਾ ਚਾਹੁੰਦਾ ਕਿਉਂਕਿ ਉਹਦੇ 'ਚ ਨਵੀਂ ਨਵੀਂ ਫੀਚਰਸ ਹੈ ਜਿੱਦਾਂ ਜੀ ਪੀ ਐਸ ਹੋ ਗਿਆ ਜਾਂ ਤੁਸੀਂ ਲੋਕੇਸ਼ਨ ਲਗਾ ਸਕਦੇ ਹੋ ਜੀ ਪੀ ਐਸ ਲਗਾ ਸਕਦੇ ਹੋ ਜਾਂ ਫੋਨ ਤੁਹਾਡਾ ਰਿਚਾਰਜ ਓ ਫੋਨ ਚਾਰਜ ਕਰ ਸਕਦੇ ਹੋ ਇੱਦਾਂ ਦੀਆਂ ਉਸ 'ਚ ਬਹੁਤ ਸਾਰੀਆਂ ਫੈਸਿਲਟੀਆਂ ਹੈਗੀਆਂ ਨੇ ਅਤੇ ਅਗਰ ਉਹ 'ਚ ਇੱਦਾਂ ਕਿ ਅਗਰ ਤੁਹਾਡਾ ਬਾਈਕ ਬਾਏ ਚਾਂਸ ਚੋਰੀ ਹੋ ਜਾਂਦਾ ਅਤੇ ਉਹ 'ਚ ਜੀ ਪੀ ਐਸ ਸਿਸਟਮ ਲੱਗਾ ਹੋਣ ਕਰਕੇ ਤੁਸੀਂ ਉਹਨੂੰ ਆਰਾਮ ਦੇ ਨਾਲ ਲੱਭ ਸਕਦੇ ਹੋ ਜਾਂ ਪੁਲਿਸ ਉਹਨੂੰ ਆਰਾਮ ਦੇ ਨਾਲ ਲੱਭ ਸਕਦੀ ਹੈ